ਹੈਲੋ ਹਾਂਜੀ ਅਨੇਜਾ ਸਵੀਟਸ ਤੋਂ ਬੋਲ ਰਹੇ ਜੀ ਮੈਂ ਅਮਨਦੀਪ ਸਿੰਘ ਬੋਲ ਰਿਹਾ ਜੀ ਮੈਂ ਆਪਣੇ ਆਜ਼ਾਦ ਨਗਰ ਦੇ ਵਿੱਚ ਇੱਕ ਔਡਰ ਕੀਤਾ ਸੀ ਹੁਣ ਜੀ ਤੁਹਾਡੇ ਸ਼ੌਪ ਤੋਂ ਮੰਗਵਾਏ ਸੀ ਆਪਾਂ ਕੁਛ ਸਵੀਟਸ ਮੰਗਵਾਈਆਂ ਸੀ ਆਪਣੇ ਗੈਸਟ ਦੇ ਲਈ ਉਹਦੇ ਵਿੱਚ ਗੁਲਾਬ ਜਾਮੁਨ ਵਗੈਰਾ ਸੀਗੀ ਅਤੇ ਡਿਲੀਵਰੀ ਮੇਰੇ ਕੋਲ ਪਹੁੰਚ ਚੁੱਕੀ ਹੈ ਜੀ ਡਿਲੀਵਰੀ ਸਹੀ ਹੋਈ ਆ ਪ੍ਰੋਡਕਟ ਬਿਲਕੁਲ ਸਹੀ ਆ ਸਾਰਾ ਬਟ ਜਦੋਂ ਮੈਂ ਟੇਸਟ ਕੀਤਾ ਜੀ ਉਹਦੇ ਵਿੱਚ ਕੁਆਲਿਟੀ ਦੇ ਵਿੱਚ ਕੀ ਹੈ ਕੋਈ ਸਮੱਸਿਆ ਆ ਰਹੀ ਸੀ ਥੋੜ੍ਹਾ ਜਿਹਾ ਖੱਟਾ ਸੀ ਆਪਣੇ ਗੁਲਾਬ ਜਾਮੁਨ ਟੇਸਟ ਦੇ ਵਿੱਚ ਸਹੀ ਨਹੀਂ ਸੀਗੀਆਂ ਜਿੱਦਾਂ ਚਾਹੀਦੀਆਂ ਨੇ ਵੈਸੇ ਰੈਗੂਲਰ ਬੇਸਿਸ 'ਤੇ ਮੈਂ ਤੁਹਾਡੇ ਤੋਂ ਕੁਛ ਨਾ ਕੁਛ ਮੰਗਵਾਉਂਦਾ ਰਹਿੰਦਾ ਇੱਦਾਂ ਦੀ ਮੈਨੂੰ ਕਦੇ ਕੰਪਲੇਂਟ ਕੋਈ ਸ਼ਿਕਾਇਤ ਨਹੀਂ ਆਈ ਬਟ ਜਿਹੜੀ ਹੈ ਇਸ ਵਾਰ ਇੱਦਾਂ ਦਾ ਹੋਇਆ ਹੈਗਾ ਤਾਂ ਮੈਂ ਚਾਹੁੰਦਾ ਗਾ ਵੀ ਜਿਹੜੀ ਹੈ ਇਸ ਮੇਰੀ ਸ਼ਿਕਾਇਤ ਨੂੰ ਦਰਜ ਕਰਦੇ ਹੋਏ ਤੁਸੀਂ ਜਿਹੜਾ ਇਸ ਔਡਰ ਨੂੰ ਜਾਂ ਤਾਂ ਵਾਪਸ ਕਰੋ ਜਾਂ ਫਿਰ ਮੇਰੇ ਪੈਸੇ ਵਾਪਸ ਕਰੋ ਕੁਛ ਤਾਂ ਕੁਛ ਕਰੋ ਕਿਉਂਕਿ ਮੈਂ ਪੈਸੇ ਲਾਏ ਨੇ ਮੈਨੂੰ ਉੱਦਾਂ ਦੀ ਕੁਆਲਿਟੀ ਵੀ ਚਾਹੀਦੀ ਆ ਤਾਂ ਜੋ ਵੀ ਤੁਹਾਡੀ ਜਿਹੜੀ ਇਹਦੀ ਹੈ ਆਪਣੀ ਵਾਪਸੀ ਦੀ ਪ੍ਰਕਿਰਿਆ ਜੋ ਵੀ ਸਿਸਟਮ ਹੈ ਮੈਨੂੰ ਦੱਸਣਾ ਕਰੋ ਅਤੇ ਮੇਰਾ ਇਹ ਤੁਸੀਂ ਔਡਰ ਵਾਪਸ ਹੀ ਕਰੋ ਕਿਉਂਕਿ ਇਹਦੇ ਵਿੱਚ ਕੁਆਲਿਟੀ ਨਹੀਂ ਹੈ ਮੈਂ ਸੈਟਿਸਫਾਈ ਨਹੀਂ ਹੈ ਤੁਹਾਡੀ ਕੁਆਲਿਟੀ ਤੋਂ ਸੰਤੁਸ਼ਟ ਨਹੀਂ ਹਾਂ ਜੀ ਓਕੇ